ਮੈਨੂੰ ਗੀਤ ਗਾਉਣ ਦਾ ਬਹੁਤ ਸ਼ੌਂਕ ਹੈ ਮੈਂ ਗੀਤ ਗਾਉਣੇ ਬਹੁਤ ਪਸੰਦ ਕਰਦਾ ਹਾਂ ਸਾਡੇ ਪਿੰਡ ਵਿੱਚ ਕਈ ਸੱਭਿਆਚਾਰ ਪ੍ਰੋਗਰਾਮ ਕਰਵਾਏ ਜਾਂਦੇ ਹਨ ਮੈਂ ਉਹਨਾਂ ਵਿੱਚ ਕਈ ਵਾਰੀ ਪਾਰਟੀਸਪੇਟ ਲ ਕੀਤਾ ਅਤੇ ਗੀਤ ਗਾਏ ਇਸ ਵਾਰ ਸਾਡੇ ਪਿੰਡ ਵਿੱਚ ਇੱਕ ਸੱਭਿਆਚਾਰਿਕ ਮੇਲਾ ਲੱਗਿਆ ਸੀ ਜਿਸ ਵਿੱਚ ਬੱਬੂ ਮਾਨ ਸਾਬ ਗੁਰਦਾਸ ਮਾਨ ਸਾਬ ਆਏ ਹੋਏ ਸਨ ਉਹ ਉਹਨਾਂ ਦੇ ਉਹ ਆਏ ਹੋਏ ਸਨ ਅਤੇ ਮੈਨੂੰ ਉੱਥੇ ਗਾਉਣ ਦਾ ਮੌਕਾ ਮਿਲਿਆ ਜਦੋਂ ਮੈਂ ਸਟੇਜ 'ਤੇ ਚੜ੍ਹਨ ਲੱਗਿਆ ਸੀ ਅਤੇ ਮੈਨੂੰ ਕਾਫੀ ਡਰ ਲੱਗਦਾ ਸੀ ਅਤੇ ਮੈਂ ਕਾਫੀ ਕੋਂਨਫੀਡੈਂਸ ਵਧਾਇਆ ਅਤੇ ਮੈਂ ਸਟੇਜ 'ਤੇ ਚੜ੍ਹਿਆ ਅਤੇ ਮੈਂ ਉੱਥੇ ਗੀਤ ਗਾਇਆ ਅਤੇ ਮੇਰੇ ਗੀਤ ਨੂੰ ਕਾ ਕਾਫੀ ਲੋਕਾਂ ਨੇ ਪਸੰਦ ਕਰਿਆ ਅਤੇ ਮੇਰੇ ਗੀਤ ਦੀ ਗੁਰਦਾਸ ਮਾਨ ਜੀ ਨੇ ਕਾਫੀ ਪ੍ਰਸੰਸਾ ਕੀਤੀ ਅਤੇ ਮੇਰਾ ਹੌਂਸਲਾ ਵਧਾਇਆ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਸਾਹਮਣੇ ਗੀਤ ਗਾ ਕੇ ਬਹੁਤ ਖੁਸ਼ੀ ਹੋਈ ਮੈਨੂੰ